ਹਾਂਜੀ ਸਤਿ ਸ਼੍ਰੀ ਅਕਾਲ ਜੀ ਜਦੋਂ ਅਸੀਂ ਬਾਈਕ ਚਲਾਉਣੀ ਸਿੱਖੀ ਸੀ ਉਦੋਂ ਅਸੀਂ ਫਰੈਂਡ ਸਰਕਲ ਦੇ ਨਾਲ ਰਲ ਕੇ ਅਸੀਂ ਇੱਕ ਦੂਸਰੇ ਨਾਲ ਰੇਸ ਲਾਉਂਦੇ ਹੁੰਦੇ ਸੀ ਇੱਕ ਦੂਸਰੇ ਨਾਲ ਮੁਕਾਬਲਾ ਕਰਦੇ ਹੁੰਦੇ ਸੀ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਸੀ ਅਤੇ ਇਸ ਨਾਲ ਸਾਨੂੰ ਐਵੇਂ ਵੀ ਪਤਾ ਲੱਗ ਜਾਂਦਾ ਸੀ ਵੀ ਮੈਂ ਬਾਇਕ ਵਧੀਆ ਚਲਾ ਸਕਦੀ ਹਾਂ ਜਾਂ ਨਹੀਂ ਅਤੇ ਬਟ ਮੈਂ ਕਦੇ ਵੀ ਸਕੂਲ ਟਾਈਮ ਦੇ ਵਿੱਚ ਜਦੋਂ ਗੇਮ ਵਗੈਰਾ ਹੁੰਦੀ ਸੀ ਉਸ ਵਿੱਚ ਕਦੇ ਵੀ ਭਾਗ ਨਹੀਂ ਲਿਆ ਸੀ ਬਟ ਫਰੈਂਡ ਸਰਕਲ ਨਾਲ ਰਲ ਕੇ ਬਾਇਕ ਵਗੈਰਾ ਬਾਇਕ ਵਗੈਰਾ ਚਲਾਉਂਦੇ ਹੁੰਦੇ ਸੀ ਰੇਸ ਲਾਉਂਦੇ ਹੁੰਦੇ ਸੀ ਇੱਕ ਦੂਸਰੇ ਨਾਲ ਰਲ ਕੇ ਤਾਂ ਇਸ ਤੋਂ ਇਹ ਅਨੁਭਵ ਹੁੰਦਾ ਸੀ ਇਹ ਪਤਾ ਲੱਗਦਾ ਸੀ ਕਿ ਮੈਂ ਵਧੀਆ ਬਾਇਕ ਚਲਾ ਸਕਦੀ ਹਾਂ ਇੱਕ ਦੂਸਰੇ ਨਾਲ ਰਲ ਕੇ ਇਹ ਹੀ ਸ ਪਤਾ ਲੱਗਦਾ ਸੀ ਵੀ ਬਾਇਕ ਕੌਣ ਵਧੀਆ ਚਲਾ ਸਕਦਾ ਕੌਣ ਨਹੀਂ ਅਤੇ ਇਸ ਨਾਲ ਐਵੇਂ ਵੀ ਹੁੰਦਾ ਸੀ ਵੀ ਹੋਰ ਵਧੀਆ ਵੀ ਚਲਾ ਪਾਉਂਦੇ ਸੀ ਬਾਇਕ ਵਗੈਰਾ ਅਤੇ ਜ਼ਿਆਦਾ ਰੇਸ ਵਗੈਰਾ ਨਹੀਂ ਦਿੰਦੇ ਸੀ ਸਲੋ ਚਲਾਉਂਦੇ ਸੀ ਬਾਇਕ ਪਰ ਅਨੁਭਵ ਬਹੁਤ ਵਧੀਆ ਹੁੰਦਾ ਸੀ ਬਹੁਤ ਵਧੀਆ ਲੱਗਦਾ ਹੁੰਦਾ ਸੀ ਪਰ ਕਦੇ ਵੀ ਗੇਮ ਵਗੈਰਾ 'ਚ ਭਾਗ ਨਹੀਂ ਲਿਆ ਸੀਂ ਅਸੀਂ ਇੱਕ ਦੂਸਰੇ ਨਾਲ ਰਲ ਕੇ ਬਹੁਤ ਹੀ ਵਧੀਆ ਚਲਾ ਲੈਂਦੇ ਸੀ ਬਾਇਕ ਇੱਕ ਫਰੈਂਡ ਸਰਕਲ ਨਾਲ ਰਲ ਕੇ ਹੀ ਬਾਇਕ ਵਗੈਰਾ ਵਧੀਆ ਨਾਲੇ ਤਾਂ ਸਿੱਖ ਪਾਉਂਦੇ ਸੀ ਨਾਲੇ ਇੱਕ ਦੂਸਰੇ ਨਾਲ ਅਸੀਂ ਇੰਜੋਆਏ ਵੀ ਕਰ ਲੈਂਦੇ ਸੀ ਬਾਇਕ ਚਲਾਉਣਾ ਮੈਨੂੰ ਬਹੁਤ ਹੀ ਵਧੀਆ ਲੱਗਦਾ ਬਾਇਕ ਚਲਾ ਕੇ ਮੈਨੂੰ ਬਹੁਤ ਹੀ ਪਸੰਦ ਆ ਬਾਇਕ ਵਗੈਰਾ ਚਲਾਉਣੀ ਬਟ ਅਸੀਂ ਫਰੈਂਡ ਸਰਕਲ ਨਾਲ ਰਲ ਕੇ ਅਸੀਂ ਇੱਕ ਦੂਸਰੇ ਨਾਲ ਰਲ ਕੇ ਇੱਕ ਦੂਸਰੇ ਨਾਲ ਰੇਸ ਵੀ ਲਗਾ ਲੈਂਦੇ ਸੀ ਤਾਂ ਵਧੀਆ ਲੱਗਦਾ ਸੀ ਬਾਇਕ ਚਲਾਉਣੀ ਅਤੇ ਇਹੀ ਅਨੁਭਵ ਹੁੰਦਾ ਹੈ ਕਿ ਵੀ ਬਾਇਕ ਚਲਾਉਣੀ ਵਧੀਆ ਲੱਗਦੀ ਆ ਹਾਂਜੀ ਇਸ ਨਾਲ ਚੰਗੀ ਤਰ੍ਹਾਂ ਸਿੱਖ ਵੀ ਪਾਉਂਦੇ ਸੀ ਅਤੇ ਵੈਸੇ ਵੀ ਇੰਨਜੋਆਏਮੈਂਟ ਵੀ ਹੋ ਜਾਂਦੀ ਸੀ ਇੱਕ ਫਰੈਂਡ ਸਰਕਲ ਨਾਲ ਵਧੀਆ ਲੱਗਦਾ ਸੀ ਹਾਂਜੀ ਸਤਿ ਸ਼੍ਰੀ ਅਕਾਲ ਜੀ